ਸਤਿ ਸ਼੍ਰੀ ਅਕਾਲ ਜੀ ਟੈਕਨੋਲਜੀ ਦੇ ਆਉਣ ਨਾਲ ਬਿਜਲੀ ਦੀ ਖਪਤ ਵਧੀ ਹੈ ਅਤੇ ਤੁਹਾਨੂੰ ਕੀ ਲੱਗਦਾ ਹੈ ਕਿ ਆਉਣ ਵਾਲੇ ਸਮੇਂ 'ਚ ਬਿਜਲੀ ਨਾਲ ਸੰਬੰਧਿਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਹਾਂਜੀ ਹੋ ਸਕਦਾ ਇੱਦਾਂ ਦਾ ਬਾਕੀ ਟੈਕਨੋਲਜੀ ਦੇ ਆਉਣ ਨਾਲ ਬਿਜਲੀ ਦੀ ਖਪਤ ਵਧੀ ਹੈ ਬਾਕੀ ਹੋਰ ਵੀ ਅੱਗੋਂ ਨਵੀਆਂ ਨਵੀਆਂ ਤਕਨੀਕਾਂ ਆ ਰਹੀਆਂ ਨੇ ਉਹਦੇ ਨਾਲ ਬਿਜਲੀ ਦੀ ਖਪਤ ਘੱਟ ਵੀ ਸਕਦੀ ਹੈ ਜਿੱਦਾਂ ਅਸੀਂ ਸੋਲਰ ਸਿਸਟਮ ਆ ਗਿਆ ਅੱਜ ਦੇ ਜ਼ਮਾਨੇ 'ਚ ਉਹਦੇ ਨਾਲ ਵੀ ਕਈ ਮੁਸ਼ਕਲਾਂ ਦਾ ਹੱਲ ਹੋ ਜਾਣਾ ਹੈ ਇਸ ਕਰਕੇ ਟੈਕਨੋਲਜੀ ਦੇ ਆਉਣ ਦੇ ਨਾਲ ਹੋਰ ਵੀ ਨਵੀਆਂ ਟੈਕਨੋਲਜੀਆਂ ਆ ਗਈਆਂ ਨੇ ਕਿ ਬਿਜਲੀ ਤੋਂ ਇਲਾਵਾ ਵੀ ਅਸੀਂ ਸੋਲਰ ਸਿਸਟਮ ਦੇ ਨਾਲ ਸਾਡੀਆਂ ਮੁਸ਼ਕਲਾਂ ਦਾ ਹੱਲ ਹੋ ਜਾਣਾ ਹੈ ਅਤੇ ਅੱਗੋਂ ਨਵੀਆਂ ਨਵੀਆਂ ਤਕਨੀਕਾਂ ਦੇ ਨਾਲ ਨਵੇਂ ਨਵੇਂ ਆਈਡੀਆ ਲੋਕਾਂ ਨੂੰ ਆਉਂਦੇ ਨੇ ਅਤੇ ਨਵੀਆਂ ਨਵੀਆਂ ਚੀਜ਼ਾਂ ਬਣਦੀਆਂ ਨੇ ਜਿਹਦੇ ਨਾਲ ਬਿਜਲੀ ਦੀ ਖਪਤ ਘੱਟ ਜਾਣੀ ਹੈ ਅਤੇ ਉਸ ਤੋਂ ਬਾਅਦ ਫਰਕ ਪਵੇਗਾ ਅੱਗੋਂ ਬਿਜਲੀ ਦੇ ਬਿਜਲੀ ਤੋਂ ਇਲਾਵਾ ਵੀ ਸੋਲਰ ਸਿਸਟਮ ਦੇ ਨਾਲ ਵੀ ਹਰ ਚੀਜ਼ ਚਲ ਜਾਣੀ ਹੈ ਅਤੇ ਉਹਦੇ ਨਾਲ ਵੀ ਜਿੱਦਾਂ ਜਿੱਦਾਂ ਟੈਕਨੋਲੋਜੀ ਆਉਂਦੀ ਉੱਦਾਂ ਉੱਦਾਂ ਹੀ ਕੋਈ ਨਵੀਂ ਤੋਂ ਨਵੀਂ ਚੀਜ਼ ਚੱਲਦੀ ਹੈ ਜਿਹਦੇ ਨਾਲ ਬਿਜਲੀ ਦੀ ਖਪਤ ਘੱਟ ਜਾਣੀ ਹੈ ਅਤੇ ਬਾਕੀ ਸਿਸਟਮ ਨਵੇਂ ਨਵੇਂ ਆਉਣ ਦੇ ਨਾਲ ਕਈ ਲੋਕਾਂ ਦੀਆਂ ਪ੍ਰੋਬਲਮ ਦਾ ਹੱਲ ਹੁੰਦਾ ਹੈ ਅਤੇ ਬਹੁਤ ਹੀ ਵਧੀਆ ਸਿਸਟਮ ਦੇ ਨਾਲ ਛੇਤੀ ਕੰਮ ਹੋ ਜਾਂਦਾ ਹੈ ਅਤੇ ਬਿਜਲੀ ਦੀ ਖਪਤ ਅੱਜ ਤਾਂ ਬਹੁਤ ਜ਼ਿਆਦਾ ਹੈ ਬਾਕੀ ਆਉਣ ਵਾਲੇ ਸਮੇਂ ਵਿੱਚ ਘੱਟ ਸਕਦੀ ਹੈ